ਦਿਨ ਚੜ੍ਹਦੇ ਹੀ ਅਸੀਂ ਸਰੀਰਕ ਕਿਰਿਆਵਾਂ ਦੇ ਵਿੱਚ ਰੁੱਝ ਜਾਂਦੇ ਹਾਂ ਪਹਿਲਾਂ ਸਵੇਰੇ ਮੋਰਨਿੰਗ ਵਾਕ 'ਤੇ ਜਾਂਦੇ ਹਾਂ ਉਸ ਤੋਂ ਬਾਅਦ ਆਪਣੇ ਤਿਆਰ ਸ਼ਿਆਰ ਹੋ ਕੇ ਕੰਮ ਲਈ ਨਿਕਲ ਜਾਂਦੇ ਹਾਂ ਦੁਕਾਨ 'ਤੇ ਜਾ ਕੇ ਵੀ ਸਾਨੂੰ ਕਾਫ਼ੀ ਭਾਰੀ ਹੌਲਾ ਹਰ ਤਰਾਂ ਦਾ ਕੰਮ ਕਰਨਾ ਪੈਂਦਾ ਹੈ ਜਿਸ ਦੇ ਨਾਲ ਸਾਨੂੰ ਵਾਰ ਵਾਰ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਹੈ ਉਸ ਤੋਂ ਬਾਅਦ ਅਸੀਂ ਨਾਸ਼ਤਾ ਕਰਦੇ ਹਾਂ ਨਾਸ਼ਤੇ ਤੋਂ ਬਾਅਦ ਵੀ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਸ ਤੋਂ ਬਾਅਦ ਦੁਪਹਿਰੇ ਰੋਟੀ ਖਾਂਦੇ ਹਾਂ ਗਰਮੀ ਦੇ ਕਾਰਨ ਵੀ ਸਾਨੂੰ ਵਾਰ ਵਾਰ ਪਾਣੀ ਪੀਣਾ ਪੈਂਦਾ ਹੈ ਸ਼ਾਮ ਦਾ ਟਾਈਮ ਵੀ ਜਦੋਂ ਅਸੀਂ ਸੈਰ ਕਰਦੇ ਹਾਂ ਜਾਂ ਕੰਮ ਵਾਲੇ ਸਥਾਨ ਤੋਂ ਤੁਰ ਕੇ ਆਪਣੇ ਘਰ ਜਾਂਦੇ ਹਾਂ ਤਾਂ ਸਾਡੇ ਸਰੀਰ ਨੂੰ ਆਪਣੀ ਜ਼ਰੂਰਤ ਦੇ ਅਨੁਸਾਰ ਪਾਣੀ ਦੀ ਲੋੜ ਹੁੰਦੀ ਹੈ ਸਾਨੂੰ ਪਿਆਸ ਲੱਗਦੀ ਹੈ ਅਸੀਂ ਫਿਰ ਪਾਣੀ ਪੀਂਦੇ ਹਾਂ